ਮੇਰੇ ਖਿਆਲ ਵਿੱਚ ਜਿਹੜੀ ਸਾਡੀ ਪੰਜਾਬੀ ਬੋਲੀ ਹੈ ਉਹ ਸੱਭਿਆਚਾਰਕ ਵਟਾਂਦਰੇ ਅਤੇ ਸੰਚਾਰ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਸਾਡੀ ਜਿਹੜੀ ਪੰਜਾਬੀ ਭਾਸ਼ਾ ਵਾ ਉਹਨੂੰ ਮਾਂ ਬੋਲੀ ਦਾ ਵੀ ਦਰਜਾ ਦਿੱਤਾ ਗਿਆ ਹੈ ਜਦੋਂ ਅਸੀਂ ਆਪਣੇ ਸ਼ਹਿਰ ਨੂੰ ਛੱਡ ਕੇ ਕਿਸੇ ਹੋਰ ਸ਼ਹਿਰ ਜਾਂ ਕਿਸੇ ਹੋਰ ਕੰਟਰੀ ਵਿੱਚ ਜਾਂਦੇ ਹਾਂ ਅਤੇ ਉੱਥੇ ਸਾਨੂੰ ਇਕੱਲੀ ਪੰਜਾਬੀ ਨਹੀਂ ਅਸੀਂ ਬੋਲ ਸਕਦੇ ਕਿਉਂਕਿ ਜੇਕਰ ਉੱਥੋਂ ਦੇ ਲੋਕਾਂ ਨੂੰ ਪੰਜਾਬੀ ਨਾ ਆਉਂਦੀ ਹੋਈ ਤਾਂ ਸਾਨੂੰ ਤਾਂ ਮੁਸ਼ਕਿਲ ਹੋਏਗੀ ਅਤੇ ਉਹਨੂੰ ਸਾਡੀ ਬੋਲੀ ਸਮਝਣ 'ਚ ਮੁਸ਼ਕਿਲ ਹੋਏਗੀ ਅਤੇ ਇਸ ਕਰਕੇ ਜਿਹੜੀ ਸਾਨੂੰ ਹਿੰਦੀ ਆ ਅਤੇ ਇੰਗਲਿਸ਼ ਵੀ ਸਿੱਖਣ ਵੱਲ ਥੋੜ੍ਹਾ ਜੋਰ ਦੇਣਾ ਚਾਹੀਦਾ ਵਾ ਕਿਉਂਕਿ ਜਿਹੜੀ ਹਿੰਦੀ ਭਾਸ਼ਾ ਵਾ ਉਹ ਸਾਡੀ ਰਾਸ਼ਟਰੀ ਭਾਸ਼ਾ ਹੈਗੀ ਆ ਅਤੇ ਜੇ ਸਾਨੂੰ ਹਿੰਦੀ ਵੀ ਆਉਂਦੀ ਹੋਈ ਅਤੇ ਅਸੀਂ ਜਿੱਥੇ ਵੀ ਜਾਵਾਂਗੇ ਤਾਂ ਉੱਥੋਂ ਦੇ ਲੋਕਾਂ ਨਾਲ ਆਸਾਨੀ ਨਾਲ ਵਾਰਤਲਾਪ ਕਰ ਸਕਾਂਗੇ ਅਤੇ ਜਿਹੜੀ ਸਾਡੀ ਪੰਜਾਬੀ ਬੋਲੀ ਹੈਗੀ ਆ ਅਤੇ ਉਹ ਕਾਫੀ ਅਹਿਮ ਭੂਮਿਕਾ ਨਿਭਾਉਂਦੀ ਆ ਸਾਡੇ ਸੱਭਿਆਚਾਰ ਵਿੱਚ ਵੀ ਕਿਉਂਕਿ ਜਦੋਂ ਵੀ ਅਸੀਂ ਕੋਈ ਵਿਆਹ ਸ਼ਾਦੀ ਜਾਂ ਕੋਈ ਵੀ ਚੰਗਾ ਸਮਾਂ ਘਰ 'ਚ ਆਉਂਦਾ ਹੈ ਤਾਂ ਅਸੀਂ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਗਿੱਧਾ ਭੰਗੜਾ ਜਾਂ ਸੁਹਾਗ ਟੱਪੇ ਗਾ ਕੇ ਆਪਣਾ ਮਨੋਰੰਜਨ ਕਰਦੇ ਸਾਂ ਅਤੇ ਰੋਣਕਾਂ ਲਗਾਉਂਦੇ ਸਾਂ